ਹਾਂਜੀ ਮੈਂ ਸ਼ੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਜਿਹੜੀਆਂ ਉਹ ਅਕਸਰ ਹੀ ਪੋਸਟ ਕਰਦਾ ਰਹਿੰਦਾ ਹਾਂ ਇਹਨਾਂ ਤਸਵੀਰਾਂ ਨੂੰ ਜ਼ਿਆਦਾਤਰ ਮੈਂ ਫੇਸਬੁੱਕ ਉੱਤੇ ਇੰਸਟਾਗਰਾਮ ਉੱਤੇ ਅਤੇ ਸਨੈਪਚੈਟ ਉੱਤੇ ਪੋਸਟ ਕਰਦਾ ਹੈ ਤਿੰਨਾਂ ਸੋਸ਼ਲ ਮੀਡੀਆ ਦੇ ਉੱਤੇ ਮੇਰੇ ਆਪਣੇ ਆਪਣੇ ਜਿਹੜੇ ਆ ਉਹ ਵੱਖਰੇ ਖਾਤੇ ਬਣੇ ਹੋਏ ਹੈ ਅਤੇ ਇਹ ਪੋਸਟਾਂ ਸ਼ੇਅਰ ਕਰਨ ਦਾ ਮੇਰਾ ਜਿਹੜਾ ਕਾਰਨ ਆ ਉਹ ਇੱਕ ਨਹੀਂ ਇੱਕ ਤੋਂ ਜ਼ਿਆਦਾ ਕਾਰਨ ਨੇ ਇੱਕ ਤਾਂ ਇਹ ਹੈ ਵੀ ਮੇਰੀ ਪਹਿਚਾਣ ਆ ਜਿਹੜੀ ਉਹ ਮੇਰੇ ਸਮਾਜ ਦੇ ਵਿੱਚ ਬਣੀ ਰਹਿੰਦੀ ਹੈ ਲੋਕਾਂ ਨਾਲ ਰਾਬਤਾ ਜਿਹੜਾ ਮੈਂ ਇਹਦੇ ਜ਼ਰੀਏ ਰੱਖ ਪਾਉਣਾ ਅਤੇ ਲੋਕ ਮੇਰੇ ਬਾਰੇ ਜਾਣਦਾ ਜਾਣਦੇ ਰਹਿੰਦੇ ਨੇ ਮੈਂ ਕਿੱਥੇ ਹਾਂ ਕਿਵੇਂ ਹਾਂ ਅਤੇ ਮੈਂ ਲੋਕਾਂ ਬਾਰੇ ਵੀ ਕਮੈਂਟਾਂ ਦੇ ਵਿੱਚ ਜਦੋਂ ਰਾਬਤਾ ਹੁੰਦਾ ਤਾਂ ਮੈਂ ਜਾਣਦਾ ਰਹਿੰਦਾ ਲੋਕਾਂ ਦੇ ਨਾਲ ਰਾਬਤਾ ਰੱਖਣ ਦਾ ਕਰਕੇ ਵੀ ਆਪਣੇ ਆਪ ਦਾ ਹਾਲ ਚਾਲ ਦੱਸਣ ਲਈ ਵੀ ਅਤੇ ਉਹਨਾਂ ਦਾ ਜਾਨਣ ਲਈ ਵੀ ਮੈਂ ਜਿਹੜਾ ਸ਼ੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹਾਂ ਅਤੇ ਮੈਂ ਆਪਣੀਆਂ ਤਸਵੀਰਾਂ ਫੋਟੋਆਂ ਜਿਹੜੀਆਂ ਉਹ ਸ਼ੇਅਰ ਕਰਦਾ ਰਹਿੰਦਾ ਮੈਂ ਆਪਣੇ ਕੰਮ ਸੰਬੰਧਿਤ ਵੀ ਬਹੁਤ ਤਸਵੀਰਾਂ ਫੋਟੋਆਂ ਜਿਹੜੀਆਂ ਸ਼ੇਅਰ ਕਰਦਾ ਹਾਂ ਧੰਨਵਾਦ